ਹੈਲੋ ਮੇਰਾ ਨਾਮ ਸ਼ਿਵੀ ਹੈ ਮੈਂ ਸਵੀਗੀ 'ਤੇ ਔਡਰ ਕੀਤਾ ਸੀ ਅਤੇ ਜਿਹਦੇ ਵਿੱਚ ਮੈਂ ਔਡਰ ਕੀਤੀਆਂ ਸੀਗੀਆਂ ਪੰਜ ਪਲੇਟ ਪੂੜੀਆਂ ਅਤੇ ਉੱਥੇ ਆ ਰਿਹਾ ਸੀਗਾ ਕਿ ਪੱਚੀ ਮਿੰਟ ਦੇ ਅੰਦਰ ਅੰਦਰ ਜਿਹੜਾ ਔਡਰ ਹੈ ਉਹ ਡਿਲੀਵਰ ਹੋ ਜਾਵੇਗਾ ਲੇਕਿਨ ਹੁਣ ਅਪਰੋਕਸ ਪੈਂਤੀ ਕੁ ਮਿੰਟ ਹੋ ਗਏ ਨੇ ਪੈਂਤੀ ਤੋਂ ਵੀ ਉੱਤੇ ਹੀ ਹੋ ਗਏ ਨੇ ਕਿ ਹਾਲੇ ਤੱਕਰ ਮੇਰਾ ਔਡਰ ਜਿਹੜਾ ਉਹ ਮੈਨੂੰ ਨਹੀਂ ਮਿਲਿਆ ਅਤੇ ਕੀ ਤੁਸੀਂ ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰਾ ਔਡਰ ਜਿਹੜਾ ਉਹ ਕਿੰਨੀ ਦੇਰ ਤੱਕ ਆਏਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗਦਾ ਪਿਆ ਵਾ ਉੱਧਰ ਉਹਦੇ ਕਹਿੰਦੇ ਪਏ ਸੀਗੇ ਕਿ ਆਊਟ ਫੋਰ ਡਿਲੀਵਰੀ ਆ ਜੇ ਆਊਟ ਫੋਰ ਡਿਲੀਵਰੀ ਹੈਗਾ ਤਾਂ ਰਸਤਾ ਤਾਂ ਪੱਚੀ ਮਿੰਟ ਦਾ ਵੀ ਨਹੀਂ ਹੈਗਾ ਮੇਰੇ ਘਰ ਤੋਂ ਸਾਰਾ ਫੂਡ ਜਿਹੜਾ ਹੈਗਾ ਉਹ ਮੇਰਾ ਠੰਡਾ ਹੋ ਜਾਣਾ ਵਾ ਅਤੇ ਮੈਨੂੰ ਇੰਨੀ ਮਤਲਬ ਤੁਹਾਡੇ ਕੋਲੋਂ ਮੈਂ ਕਾਫ਼ੀ ਲੋਇਲ ਕਸਟਮਰ ਹੈਗੀ ਹਾਂ ਤੁਹਾਡੀ ਮੈਂ ਕਾਫ਼ੀ ਵਾਰੀ ਤੁਹਾਡੇ ਕੋਲੋਂ ਸਮਾਨ ਸਮੂਨ ਮੰਗਵਾਉਂਦੀ ਰਹਿੰਦੀ ਹਾਂ ਹਮੇਸ਼ਾ ਔਡਰ ਤੁਹਾਡੇ ਤੋਂ ਹੀ ਕਰਦੀ ਹਾਂ ਐਪ ਤੋਂ ਪਰ ਇਹ ਪਹਿਲੀ ਵਾਰ ਹੋਇਆ ਕਿ ਵੀ ਇਸ ਤਰ੍ਹਾਂ ਮਤਲਬ ਉਹਦੀ ਕੋਈ ਲੋਕੇਸ਼ਨ ਵੀ ਨਹੀਂ ਸ਼ੋਅ ਹੁੰਦੀ ਪਈ ਜਿਹੜਾ ਪਰਸਨ ਮੇਰਾ ਆਊਟ ਫੋਰ ਡਿਲੀਵਰੀ ਵਾਸਤੇ ਆਉਂਦਾ ਪਿਆ ਸੀਗਾ ਕਿ ਮੇਰਾ ਸਮਾਨ ਲੈ ਕੇ ਆ ਰਿਹਾ ਉਹਦੀ ਪਹਿਲਾਂ ਲੋਕੇਸ਼ਨ ਸ਼ੇਅਰ ਹੋ ਰਹੀ ਸੀ ਹੁਣ ਤਾਂ ਪਿਛਲੇ ਦਸ ਮਿੰਟ ਤੋਂ ਉਹਦੀ ਕੋਈ ਲੋਕੇਸ਼ਨ ਵਗੈਰਾ ਵੀ ਨਹੀਂ ਸ਼ੇਅਰ ਹੋ ਰਹੀ ਅਤੇ ਬੜੀ ਮੁਸ਼ਕਲ ਹੋਈ ਹੋਈ ਆ ਮੈਨੂੰ ਤਾਂ ਮੈਨੂੰ ਐਟ ਲੀਸਟ ਇਹ ਦੱਸਿਆ ਜਾਵੇ ਕਿ ਵੀ ਮੇਰਾ ਔਡਰ ਕਦੋਂ ਤੱਕ ਆਏਗਾ ਮੈਂ ਮਤਲਬ ਖਾਣਾ ਹੈਗਾ ਵਾ ਅਤੇ ਠੰਡਾ ਹੋ ਜਾਵੇਗਾ ਮੈਂ ਹੋਰ ਵੀ ਬਾਕੀ ਤੁਹਾਨੂੰ ਪਤਾ ਮਤਲਬ ਬਿਜ਼ੀ ਸ਼ਡਿਊਲ ਹੁੰਦਾ ਬੰਦੇ ਦਾ ਹੋਰ ਵੀ ਬੜੇ ਕੰਮ ਕਰਨੇ ਹੁੰਦੇ ਆ